ਭਾਰਤੀ ਫਿਲਮਾਂ ਅਤੇ ਸੰਗੀਤ ਬੁ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ ਕਿਉਂਕਿ ਇਹ ਪਰਿਵਾਰ ਵਿੱਚ ਵੇਖਣ ਵਾਲੇ ਅਤੇ ਦੇਸ਼ ਭਗਤੀ ਵਾਲੇ ਹੁੰਦੇ ਹਨ ਇਹਨਾਂ ਨੂੰ ਅਸੀਂ ਪਰਿਵਾਰ ਵਿੱਚ ਬੈਠ ਕੇ ਵੇਖ ਅਤੇ ਸੁਣ ਸਕਦੇ ਹਾਂ ਮੈਨੂੰ ਜ਼ਿਆਦਾਤਰ ਕਮੇਡੀ ਕਮੇਡੀ ਫਿਲਮਾਂ ਅਤੇ ਪੰਜਾਬੀ ਫਿਲਮ ਪੰਜਾਬੀ ਪਰਿਵਾਰਿਕ ਫਿਲਮਾਂ ਵੈਬ ਸੀਰੀਜ਼ ਪਸੰਦ ਹਨ ਇਹਨਾਂ ਨੂੰ ਵੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਰਿਵਾਰ ਵਿੱਚ ਬੈਠ ਕੇ ਕਿਵੇਂ ਵਿਚਰਨਾ ਹੈ ਅਤੇ ਮੇਰੀ ਫੇਵਰੇਟ ਅਦਾਕਾਰ ਜ ਮਨਪਸੰਦ ਅਦਾਕਾਰ ਨੀਰੂ ਬਾਜਵਾ ਹੈ ਅਤੇ ਇਹਦੀ ਹੁਣੇ ਹੀ ਇੱਕ ਫਿਲਮ ਆਈ ਹੈ ਬੂਹੇ ਬਾਰੀਆਂ ਜਿਸਦੇ ਵਿੱਚ ਇਸਦਾ ਪਹਿਰਾਵਾ ਬਹੁਤ ਜ਼ਿਆਦਾ ਸੋਹਣਾ ਹੈ ਅਤੇ ਇਹ ਇਸਦੇ ਅਤੇ ਇਸ ਇਸਦੀ ਇਸ ਫਿਲਮ ਵਿੱਚ ਬਹੁਤ ਵਧੀਆ ਸੰਦੇਸ਼ ਔਰਤਾਂ ਲਈ ਇਹ ਬਹੁਤ ਹੀ ਇ ਵਧੀਆ ਸੰਦੇਸ਼ਾ ਛੁਪਿਆ ਹੋਇਆ ਹੈ ਅਤੇ ਮੈਨੂੰ ਹਰਭਜਨ ਮਾਨ ਦੀ ਇੱਕ ਪੰ ਫਿਲਮ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਜੀ ਆਇਆਂ ਨੂੰ ਜਿਸਦਾ ਗੀਤ ਹੈ ਤਿੰਨ ਰੰਗ ਨਹੀਂ ਲੱਭਣੇ ਬੀਬਾ ਇਹ ਇੱਕ ਪਰਿਵਾਰਿਕ ਮੈਂਬ ਪਰਿਵਾਰਿਕ ਗੀਤ ਹੈ ਜੋ ਸਾਰਿਆਂ ਨੂੰ ਸੁਣਨ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਅਤੇ ਮੇਰੀ ਫੇਵਰੇਟ ਅਦਾ ਗਾਇਕਾ ਨਿਮਰਤ ਖੈਰਾ ਹੈ ਅਤੇ ਇਸਦਾ ਹਾਲ ਹੀ ਵਿੱਚ ਇੱਕ ਗੀਤ ਆਇਆ ਹੈ ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਵਿੱਚੋਂ ਆਈ ਹਾਂ ਅਤੇ ਇਸਦੇ ਵਿੱਚ ਦੱਸਿਆ ਗਿਆ ਦਾਦੀਆਂ ਨਾਨੀਆਂ ਦੇ ਸਮੇਂ ਦੀ ਗੱਲ ਕੀਤੀ ਹੈ ਜੋ ਦੱਸਦੀ ਹੈ ਕਿ ਦਾਦੀਆਂ ਨਾਨੀਆਂ ਦੇ ਟਾਈਮ ਵਿੱਚ ਕੀ ਕੀ ਸੀ ਜੋ ਸਾਨੂੰ ਨਹੀਂ ਪਤਾ ਹੈ ਉਸਦੇ ਬਾਰੇ ਵਿੱਚ ਦੱਸਿਆ